ਮੈਂ ਵਹਿਮਾਂ ਭਰਮਾਂ ਤੇ ਵਿਸ਼ਵਾਸ ਨਹੀਂ ਕਰਦੀ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਕਰਦੀ ਆਪਣਾ ਪਾਠ ਕਰਦੀ ਹਾਂ ਉਹਨਾਂ ਦੇ ਵਿਸ਼ਵਾਸ ਵਹਿਮਾ ਭਰਮਾਂ ਚ ਮੈਂ ਕਦੇ ਵਿਸ਼ਵਾਸ ਨਹੀਂ ਕੀਤਾ ਚਾਹੇ ਲੋਕੀ ਕਹਿੰਦੇ ਆ ਵੀਰਵਾਰ ਕੱਪੜੇ ਨੀ ਧੋਣੇ ਮੰਗਲਵਾਰ ਕੱਪੜੇ ਨੀ ਧੋਣੇ ਮੈਂ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੀ ਬਹੁਤ ਲੋਕੀ ਐਂ ਕਹਿੰਦੇ ਆਹ ਧੋਇਆ ਕਰੋ ਕਰਿਆ ਕਰੋ ਤੇ ਮੈਂ ਵਿਸ਼ਵਾਸ ਕਰਦੀ ਨੀ ਮੈਂ ਧੋ ਲੈਂਦੀ ਆ ਸਾਰੇ ਕੱਪ ਸਾਰੇ ਕੰਮ ਕਰ ਲੈਂਦੀ ਆ ਮੈਂ ਵਿਸ਼ਵਾਸ ਕਿਸੇ ਤੇ ਨਹੀਂ ਕੀਤਾ